ਪਟਿਆਲਾ ਬਹੁਤ ਵੱਡਾ ਸ਼ਹਿਰ ਹੈ ਜਿਸ ਵਿੱਚ ਬਹੁਤ ਸਰਕਾਰੀ ਸਕੂਲ ਅਤੇ ਸਰਕਾਰੀ ਕਾਲਜ ਹਨ ਜਿਵੇਂ ਕਿ ਮਹਿੰਦਰਾ ਕਾਲਜ ਬਿਕਰਮ ਕਾਲਜ ਸਰਕਾਰੀ ਸਕੂਲ ਜਿਵੇਂ ਕਿ ਗਰਲ ਸਕੂਲ ਬੋਆਏ ਸਕੂਲ ਇਹਨਾਂ ਵਿੱਚ ਬਹੁਤ ਵਧੀਆ ਬੱਚਿਆਂ ਨੂੰ ਸਿੱਖਿਆ ਦਿੱਤੀ ਜਾਂਦੀ ਹੈ ਘਰ ਬਾਰੇ ਪੜ੍ਹਾਈ ਬਾਰੇ ਆਪਣੇ ਮਾਤਾ ਪਿਤਾ ਦੀ ਸੇਵਾ ਕਿਵੇਂ ਕਰਨੀ ਹੈ ਸਭ ਕੁਛ ਦੱਸਿਆ ਜਾਂਦਾ ਹੈ ਅਤੇ ਪਟਿਆਲਾ ਜੀ ਦਾ ਜ਼ਿਲ੍ਹਾ ਬਹੁਤ ਮਸ਼ਹੂਰ ਹੈ